ਹਾਂਜੀ ਆਪਾਂ ਖਾਣੇ ਦਾ ਔਡਰ ਤਾਂ ਹੈ ਨਾ ਤੁਹਾਡੇ ਕੋਲ ਕਰ ਲਿਆ ਅਤੇ ਇੱਦਾਂ ਕਰੋ ਮੈਨੂੰ ਇਹ ਦੱਸੋ ਵੀ ਤੁਹਾਡੇ ਕੋਲ ਪੀਣ ਦੇ ਵਿੱਚ ਨਾ ਕੀ ਕੁਛ ਆ ਜਿੱਦਾਂ ਕੋਲਡ ਡਰਿੰਕ ਹੋ ਗਿਆ ਜੂਸ ਹੋ ਗਿਆ ਜਾਂ ਲੱਸੀ ਵਗੈਰਾ ਕੁਛ ਹੋਰ ਉਹ ਅੱਛਾ ਮਤਲਬ ਜੂਸ ਹੈ ਜੂਸ ਦੇ ਵਿੱਚ ਫਿਰ ਇਦਾਂ ਕਰੋ ਤੁਸੀਂ ਨਾ ਆਪਾਂ ਵੱਖ ਵੱਖ ਟੇਬਲਾਂ 'ਤੇ ਦੇਣਾ ਇੱਕ ਨੰਬਰ ਟੇਬਲ 'ਤੇ ਤੁਸੀਂ ਦੇ ਦਿਉ ਮਿਕਸ ਜੂਸ ਅਤੇ ਦੋ 'ਤੇ ਦੇ ਦਿਉ ਤੁਸੀਂ ਔਰੇਂਜ ਅਤੇ ਤਿੰਨ ਨੰਬਰ 'ਤੇ ਦੇ ਦਿਉ ਮੈਂਗੋ ਜੂਸ ਅਤੇ ਚਾਰ 'ਤੇ ਤੁਸੀਂ ਫਿਰ ਬੇਸ਼ੱਕ ਲੱਸੀ ਦੇ ਦਿਓ ਪਰ ਇੱਦਾਂ ਕਰਿਓ ਕੋਸ਼ਿਸ਼ ਕਰੋ ਨਾ ਵੀ ਜ਼ਿਆਦਾ ਠੰਡਾ ਨਾ ਹੋਵੇ ਕਿਉਂਕਿ ਹੁਣ ਮੌਸਮ ਵੀ ਐਵੇਂ ਦਾ ਗਲੇ ਗੁਲੇ ਖਰਾਬ ਹੋ ਜਾਂਦੇ ਤੁਸੀਂ ਨਾ ਹਾਂ ਸਿੰਪਲ ਦੇ ਦਿਉ ਕੋਈ ਮਿੱਠਾ ਵੀ ਮਿਕਸ ਨਾ ਕਰਿਓ ਅਤੇ ਨਾ ਹੀ ਵਿੱਚ ਬਰਫ ਹੋਵੇ ਹਾਂਜੀ ਹਾਂਜੀ ਚਾਰ ਨੰਬਰ 'ਤੇ ਤੁਸੀਂ ਨਮਕੀਨ ਲੱਸੀ ਦੇ ਦਿਓ ਉਹ ਚੱਲੇਗੀ ਹਾਂਜੀ ਹਾਂਜੀ ਹਾਂਜੀ ਦੇ ਦਿਓ ਓਕੇ